ਹੈਲੋ ਨਮਸਕਾਰ ਸਰ ਹਾਂਜੀ ਮੈਂ ਨਿਊ ਪਾਪੋਰਟ ਦਿੱਤਾ ਸੀਗਾ ਜੀ ਬਣਨ ਉਹ ਮੈਂ ਮੋਬਾਈਲ 'ਤੇ ਤਾਂ ਚੈੱਕ ਕਰਿਆ ਸੀ ਵੀ ਉਹਦੀ ਜਿਹੜੀ ਸਹੀ ਪ੍ਰਕਿਰਿਆ ਉਹ ਹੋ ਗਈ ਹੈ ਅਤੇ

ਤਾਂ ਹੁਣ ਮੈਨੂੰ ਇਹ ਸ਼ੋਅਰ ਨਹੀਂ ਹੋ ਰਿਹਾ ਵੀ ਉਹ ਤੁਹਾਡੇ ਕਨੀਓ ਅਪਡੇਟ ਹੋਇਆ ਕਿ ਨਹੀਂ ਹਾਂ ਜੀ ਇੱਧਰੋਂ ਕਿੰਨੇ ਕੁ ਦਿਨ ਲੱਗ ਜਾਣਗੇ ਮੇਰੇ ਕੋਲ ਆਉਂਦੇ ਨੂੰ ਹਾਂਜੀ ਹਾਂ ਰੀਨਿਊ ਕਰਾਇਆ ਸੀਗਾ ਜੀ ਰੀਨਿਊ ਚੈਕ ਕਰਿਓ ਜੀ

ਹਾਂਜੀ ਬਸ ਥੋੜ੍ਹੇ ਦਿਨ ਹੀ ਹੋਏ ਆ ਜੀ

ਠੀਕ ਹੈ ਜੀ ਕਿੰਨੇ ਕੁ ਦਿਨਾਂ ਤੱਕ ਵੀ ਪਤਾ ਲੱਗ ਜਾਊਗਾ ਵੈਸੇ ਤਾਂ ਮੈਂ ਇੰਟਰਨੈਟ 'ਤੇ ਚੈੱਕ ਕਰ ਲਿਆ ਸੀ

ਠੀਕ ਹੈ ਜੀ ਥੈਂਕ ਯੂ ਸਰ